ਜੇਕਰ ਅਸੀਂ ਇੱਕ ਨਵਾਂ ਗੈਜਿਟ ਔਨਲਾਈਨ ਮੰਗਾਇਆ ਹੈ ਪਰ ਸਾ ਸਾਨੂੰ ਉਸ ਦੀ ਡਲਿਵਰੀ ਸਥਿਤੀ ਬਾਰੇ ਕੋਈ ਅਪਡੇਟ ਨਹੀਂ ਮਿਲੀ ਤਾਂ ਅਸੀਂ ਉਸ ਔਨਲਾਈਨ ਵੈਬਸਾਈਟ 'ਤੇ ਜਾ ਕੇ ਕਸਟਮਰ ਕੇਅਰ ਨੰਬਰ ਨਾਲ ਸੰਪਰਕ ਕਰਾਂਗੇ ਅਤੇ ਆਪਣੇ ਗੈਜਿਟ ਦੀ ਡਲਿਵਰੀ ਸਥਿਤੀ ਬਾਰੇ ਜਾਣਕਾਰੀ ਲਵਾਂਗੇ ਜੇਕਰ ਉਹਨਾਂ ਦੁਆਰਾ ਜਾਣਕਾਰੀ ਨਾ ਦਿੱਤੀ ਗਈ ਤਾਂ ਅਸੀਂ ਉਸ ਓਡਰ ਨੂੰ ਕੈਂਸਲ ਵੀ ਕਰ ਸਕਦੇ ਹਾਂ